ਨਮਸਕਾਰ ਹਾਂਜੀ ਹਾਂਜੀ ਅੱਛਾ ਜੀ ਦੱਸੋ ਜੀ ਏ ਫੋਰ ਏ ਫੋਰ ਅੱਛਾ ਜੀ ਠੀਕ ਹੈ ਜੀ ਮਿਲ ਜਾਣਗੇ ਅੱਛਾ ਜੀ ਆ ਏ ਫੋਰ ਮਤਲਬ ਪੇਜਸ ਦੇ ਜਾਂ ਵੀ ਕਾਪੀਆਂ ਦੇ ਅੱਛਾ ਜੀ ਠੀਕ ਹੈ ਜੀ ਏ ਫੋਰ ਕੋਪੀਜ ਠੀਕ ਹੈ ਜੀ ਕਿੰਨੀਆਂ ਅੱਛਾ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਹੋਰ ਅੱਛਾ ਜੀ ਤਿੰਨ ਬਟਰ ਫਲੋਰੀ ਕਿੰਨੇ ਠੀਕ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਹਾਂ ਮਿਲ ਜਾਏਗੀ ਠੀਕ ਹੈ ਜੀ ਠੀਕ ਹੈ ਹਾਂ ਮਿਲ ਜਾਣਗੀਆਂ ਠੀਕ ਹੈ ਜੀ ਪੈਕਟ ਹੋਰ ਅੱਛਾ ਜੀ ਪਹੁੰਚਾ ਦਿਆਂਗੇ ਕੱਲ੍ਹ ਪਰਸੋਂ ਤੱਕ ਅੱਛਾ ਜੀ ਬਾਕੀ ਮੈਡਮ ਸਾਡੇ ਨਾ ਕੱਲ੍ਹ ਨੂੰ ਆਵੇਗਾ ਜਿਹੜਾ ਵਹੀਕਲ ਹੈਗਾ ਉਹ ਪਿੰਡ ਵਿੱਚ ਜਾਏਗਾ ਅਤੇ ਕੱਲ੍ਹ ਤੱਕ ਪਹੁੰਚਾ ਸਕਦੇ ਹਾਂ ਚਲੋ ਠੀਕ ਆ ਜੀ ਹੋਰ ਇਸ ਤੋਂ ਇਲਾਵਾ ਉਹਦੇ 'ਚ ਬਾਰਾਂ ਹੁੰਦੇ ਆ ਇੱਕ ਵਿੱਚ ਅਤੇ ਪੰਦਰਾਂ ਵਾਲਾ ਵੀ ਹੈਗਾ ਠੀਕ ਹੈ ਜੀ ਠੀਕ ਹੈ ਦੋ ਡੱਬੇ ਠੀਕ ਹੈ ਜੀ ਅਤੇ ਕਿਹੜੀ ਕੰਪਨੀ ਦੀ ਚਾਹੀਦੀ ਹੈ ਨਟਰਾਜ ਜਾਂ ਐਸਪਰਾ ਠੀਕ ਹੈ ਜੀ ਠੀਕ ਹੈ ਚਲੋ ਕੋਈ ਨਹੀਂ ਕਰਦੇ ਹਾਂ ਜੀ ਅਤੇ ਹੋਰ ਇਸ ਤੋਂ ਇਲਾਵਾ ਚਲੋ ਸਕੈਚ ਉਹ ਕਿੰਨੇ ਡੱਬੇ ਠੀਕ ਹੈ ਜੀ ਠੀਕ ਹੈ ਹਾਂਜੀ ਹਾਂਜੀ ਅਤੇ ਮਤਲਬ ਅਡਰੈਸ ਦਾ ਮੈਨੂੰ ਵਟਸਐਪ ਕਰਦਿਆ ਜੇ ਅਤੇ ਅਸੀਂ ਭੇਜ ਦਿਆਂਗੇ ਹਾਂਜੀ ਹਾਂਜੀ ਚਲੋ ਕੋਈ ਨਾ ਜੀ ਠੀਕ ਅੱਛਾ ਅਸਾਈਨਮੈਂਟ ਸ਼ੀਟ ਅੱਛਾ ਜੀ ਉਹਦੇ ਕਿੰਨੇ ਅੱਛਾ ਡਿਜਾਇਨ ਦਸ ਠੀਕ ਹੈ ਜੀ ਠੀਕ ਹੈ ਜੀ ਠੀਕ